ਅਸੀਂ ਆਪਣੇ ਸ਼ਿਲਪਕਾਰੀ ਖੇਤਰ ਰਾਜ ਦੀ ਸੱਭਿਆਚਾਰਕ ਪਛਾਣ ਅਤੇ ਵਿਰਾਸਤ ਵਿੱਚ ਇਸ ਤਰ੍ਹਾਂ ਯੋਗ ਪਾਉਂਦੇ ਹਾਂ ਜਿਵੇਂ ਗੁਰਪੁਰਬ 'ਤੇ ਗੱਤਕਾ ਖੇਡਿਆ ਜਾਂਦਾ ਹੈ ਕੋਈ ਤਿਉਹਾਰ 'ਤੇ ਭੰਗੜਾ ਹੁੰਦਾ ਹੈ ਗਿੱਧਾ ਹੁੰਦਾ ਹੈ ਇਸ ਤਰ੍ਹਾਂ ਅਸੀਂ ਆਪਣੀ ਖੁਸ਼ੀ ਦਾ ਖੁਸ਼ੀ ਦਾ ਇਜ਼ਹਾਰ ਕਰਦੇ ਹਾਂ ਤਿਉਹਾਰਾਂ 'ਤੇ ਨੱਚ ਟੱਪ ਕੇ ਇਸ ਤਰ੍ਹਾਂ ਇਹਨਾਂ ਨਾਲ ਅਸੀਂ ਆਪਣੀ ਵਿਰਾਸਤ ਵਿੱਚ ਯੋਗਦਾਨ ਪਾਉਂਦੇ ਹਾਂ